ਜਿਵੇਂ ਕਿ ਆਪਾਂ ਦੇਖ ਹੀ ਸਕਦੇ ਹੈਗੇ ਵੀ ਜਦੋਂ ਆਪਾਂ ਘਰ ਵਿੱਚ ਖਾਣਾ ਪਕਾਉਂਦੇ ਹਾਂ ਤਾਂ ਆਪਣੇ ਘਰਾਂ ਦੇ ਵਿੱਚ ਆਲਮੋਸਟ ਐਲ ਪੀ ਜੀ ਸਿਲੰਡਰਸ ਵਗੈਰਾ ਤਾਂ ਹੁੰਦੇ ਆ ਵੀ ਕਈ ਪਿੰਡਾਂ ਵਾਲੇ ਹੁੰਦੇ ਹੈਗੇ ਵੀ ਉਹ ਚੁੱਲ੍ਹੇ 'ਤੇ ਕੰਮ ਕਰਦੇ ਹੁੰਦੇ ਆ ਬਟ ਸ਼ਹਿਰਾਂ ਦੇ ਵਿੱਚ ਕੀ ਆ ਆਲਮੋਸਟ ਸਾਰੇ ਘਰ ਆ ਕਿ ਜਿਹੜੇ ਉਹ ਐਲ ਪੀ ਜੀ ਸਿਲੰਡਰ ਦੀ ਵਰਤੋਂ ਕਰਦੇ ਆ ਐਂਡ ਜਿਹੜੇ ਸ਼ਹਿਰਾਂ ਵਾਲੇ ਲੋਕ ਐਲ ਪੀ ਜੀ ਸਲੰਡਰ ਦੀ ਵਰਤੋਂ ਕਰਦੇ ਆ ਉਹਨਾਂ ਨੂੰ ਕੀ ਆ ਕੁਝ ਕੁ ਸਾਵਧਾਨੀਆਂ ਦਾ ਵੀ ਧਿਆਨ ਰੱਖਣਾ ਪੈਂਦਾ ਹੈਗਾ ਵੀ ਜਿਵੇਂ ਅਗਰ ਉਹਨਾਂ ਨੇ ਖਾਣਾ ਨਹੀਂ ਪਕਾਉਣਾ ਤਾਂ ਉਹਨਾਂ ਨੂੰ ਕੀ ਆ ਸਿਲਿੰਡਰ ਬੰਦ ਕਰ ਦੇਣਾ ਚਾਹੀਦਾ ਤਾਂ ਕਿ ਕੋਈ ਵੀ ਐਲ ਪੀ ਜੀ ਗੈਸ ਹੈਗੀ ਐਗੀ ਉਹ ਲੀਕ ਨਾ ਹੋਵੇ ਵੀ ਜਦੋਂ ਉਹਨਾਂ ਨੇ ਖਾਣਾ ਤਿਆਰ ਕਰਨਾ ਹੈਗਾ ਵੀ ਉਹ ਉਦੋਂ ਹੀ ਉਸ ਗੈਸ ਦੀ ਐਲ ਪੀ ਜੀ ਨੂੰ ਕੀ ਆ ਛੱਡਣ ਜਾਂ ਫਿਰ ਕਿਤੋਂ ਪਾਈਪਲਾਈਨ ਵਗੈਰਾ ਲੀਕ ਹੁੰਦੀ ਹੈਗੀ ਤਾਂ ਉਹਨਾਂ ਦੇ ਮਤਲਬ ਜਿਵੇਂ ਪੰਜਾਬੀ ਦੇ ਵਿੱਚ ਵਰਡ ਆ ਵੀ ਥੁੱਕ ਲਾ ਕੇ ਵੇਖ ਸਕਦੇ ਹੈਗੇ ਵੀ ਕਿੱਥੋਂ ਲੀਕ ਹੋ ਰਹੀ ਹੈ ਕਿੱਥੋਂ ਨਹੀਂ ਹੋ ਰਹੀ ਹੈਗੀ ਵੀ ਟਾਈਮ ਟੂ ਟਾਈਮ ਕਿ ਆਪਾਂ ਨੂੰ ਸਾਰੀਆਂ ਐਲ ਪੀ ਜੀ ਸਲੰਡਰਸ ਵਗੈਰਾ ਦੀ ਕੀ ਆ ਸਰਵਿਸ ਵਗੈਰਾ ਕਰਵਾਉਣੀ ਚਾਹੀਦੀ ਹੈਗੀ ਅੱਜ ਕੱਲ੍ਹ ਤਾਂ ਲੋਕ ਹੈਗੇ ਐਗੇ ਜਿਹੜੇ ਉਹ ਕੀ ਆ ਪਾਈਪਸ ਵਗੈਰਾ ਵੀ ਪਵਾ ਰਹੇ ਨੇਗੇ ਸਿਲੰਡਰ ਵਗੈਰਾ ਦੀਆਂ ਵੀ ਆਟੋਮੈਟਿਕਲੀ ਆਊਗਾ ਸ ਗੈਸ ਆਊਗੀ ਤਾਂ ਉਹਦੇ ਨਾਲ ਕੀ ਆ ਜਿੰਨਾ ਜਿੰਨੀ ਗੈਸ ਆਊਗੀ ਓਨਾ ਹੀ ਲੋਕਾਂ ਨੂੰ ਬਿੱਲ ਭਰਨਾ ਪੈਣਾ ਅੱਜ ਕੱਲ੍ਹ ਦੇ ਮੋਡਰਨ ਟੈਕਨੋਲੋਜੀ ਦੇ ਵਿੱਚ ਇਹ ਹੈਗਾ ਗਾ ਠੀਕ ਹੈ ਐਂਡ ਜਦੋਂ ਆਪਾਂ ਕੋਈ ਜਿਵੇਂ ਆਪਾਂ ਸਿਲੰਡਰ ਦਾ ਯੂਜ ਮੋਸਟਲੀ ਆਪਾਂ ਭੱਠੀਆਂ ਵਗੈਰਾ ਚਲਾਉਣ ਦੇ ਲਈ ਵੀ ਕਰ ਸਕਦੇ ਹੈਗੇ ਵੀ ਜਦੋਂ ਆਪਾਂ ਕੋਈ ਵੀ ਭੱਠੀ ਵਗੈਰਾ ਚਲਾਉਂਦੇ ਹੈਗੇ ਹੈਗੇ ਤਾਂ ਆਪਾਂ ਨੂੰ ਚੈੱਕ ਕਰਨਾ ਚਾਹੀਦਾ ਹੈਗਾ ਵੀ ਭੱਠੀ ਦਾ ਫਲੋ ਕਿਤੇ ਗੈਸ ਦਾ ਫਲੋ ਹੈਗਾ ਜਾਂ ਭੱਠੀ ਦਾ ਹੈਗਾ ਵੀ ਉਹ ਕਿਤੇ ਤੇਜ਼ ਤਾਂ ਨਹੀਂ ਅਗਰ ਉਹ ਭੱਠੀ ਦਾ ਫਲੋ ਹੈਗਾ ਗਾ ਜਿਹੜਾ ਤੇਜ਼ ਹੋਊਗਾ ਤਾਂ ਉਹਦੇ ਨਾਲ ਕੋਈ ਜਿਹੜੀਆਂ ਹੈਗੀਆਂ ਸੁਰੱਖਿਆ ਨਹੀਂ ਹੋ ਪਾਊਗੀ ਵੀ ਕਈਆਂ ਨੂੰ ਸੱਟ ਵਗੈਰਾ ਲੱਗਣ ਦਾ ਡਰ ਹੁੰਦਾ ਹੈਗਾ ਠੀਕ ਹੈ ਅਤੇ ਹੋਰ ਆਪਾਂ ਜਿਵੇਂ ਵੇਖ ਸਕਦੇ ਹੈਗੇ ਐਗੇ ਵੀ ਐਲ ਪੀ ਜੀ ਸਿਲੰਡਰ ਹੈਗਾ ਕਈ ਵਾਰੀ ਭੁਲੇਖੇ ਦੇ ਨਾਲ ਕਿਸੇ ਤੋਂ ਚੱਲਿਆ ਬਟਨਸ ਵਗੈਰਾ ਹੁੰਦੇ ਹੈਗੇ ਉਹ ਚੱਲਦੇ ਛੱਡੇ ਜਾਂਦੇ ਹੈਗੇ ਠੀਕ ਹੈ ਤਾਂ ਉਹਦੇ ਨਾਲ ਕੀ ਆ ਸਾਰੇ ਕਮਰਿਆਂ ਵਗੈਰਾ 'ਚ ਸਾਰੇ ਘਰ ਵਗੈਰਾ ਦੇ ਵਿੱਚ ਕੀ ਹੈਗਾ ਐਗਾ ਗੈਸ ਫੈਲ ਜਾਂਦੀ ਹੈਗੀ ਤਾਂ ਉਸ ਟਾਈਮ ਦੇ ਵਿੱਚ ਕੀ ਹੈਗਾ ਨਾ ਤਾਂ ਆਪਾਂ ਨੂੰ ਕੋਈ ਵੀ ਅੱਗ ਵਗੈਰਾ ਦਾ ਯੂਜ ਕਰਨਾ ਚਾਹੀਦਾ ਨਾ ਹੀ ਕੋਈ ਇਲੈਕਟਰੋਨਿਕ ਚੀਜ਼ ਹੈਗੀ ਐਗੀ ਅਗਰ ਉਹ ਛੱਡੀ ਆ ਤਾਂ ਉਹਨੂੰ ਛੱਡੀ ਰਹਿਣ ਦੇਣੀ ਚਾਹੀਦੀ ਹੈ ਸਾਰੀਆਂ ਖਿੜਕੀਆਂ ਦਰਵਾਜ਼ੇ ਹੈਗੇ ਐਗੇ ਉਹ ਸਾਰੇ ਖੋਲ੍ਹ ਦੇਣੇ ਚਾਹੀਦੇ ਹੈਗੇ ਹੈਗੇ ਤਾਂ ਕਿ ਸਾਰੀ ਜਿਹੜੀ ਗੈਸ ਹੈਗੀ ਐਗੀ ਉਹ ਬਾਹਰ ਨੂੰ ਚਲੀ ਜਾਵੇ ਸੋ ਇਹ ਇਹੀ ਆ ਵੀ ਘਰ ਵਿੱਚ ਜਦੋਂ ਆਪਾਂ ਕੋਈ ਵੀ ਖਾਣਾ ਪਕਾਉਣਾ ਹੈਗਾ ਤਾਂ ਐਲ ਪੀ ਜੀ ਸਲੰਡਰ ਦੀ ਵਰਤੋਂ ਕਰਦੇ ਐਂਗੇ ਆਪਾਂ ਤਾਂ ਉਹਦੇ ਲਈ ਆਪਾਂ ਨੂੰ ਇਹਨਾਂ ਇਹਨਾਂ ਸਾਵਧਾਨੀਆਂ ਦੀ ਵੀ ਵਰਤੋਂ ਕਰਨੀ ਪੈਂਦੀ ਐਗੀ